ਮੈਂ ਨਾ ਚਾਵਲ ਬਣਾਉਣ ਵਿੱਚ ਬਹੁਤ ਐਕਸਪਰਟ ਹੈ ਜਦੋਂ ਮੇਰੀ ਭਾਬੀ ਨੇ ਦੇਖਿਆ ਕਿ ਮੈਂ ਚਾਵਲ ਬਹੁਤ ਅੱਛੇ ਬਣਾਉਂਦੀ ਹੈ ਤਾਂ ਉਹਨਾਂ ਨੇ ਮੇਰੇ ਕੋਲੋਂ ਪੁੱਛਿਆ ਕਿ ਇਹ ਕਿੱਦਾਂ ਬਣਾਏ ਹੈ ਅਤੇ ਮੈਂ ਉਹਨਾਂ ਨੂੰ ਸਾਰਾ ਮੈਥਡ ਦੱਸਿਆ ਕਿ ਇੱਦਾਂ ਬਣਾਈਦੇ ਹੈ ਅਤੇ ਉਹਨਾਂ ਨੇ ਵੀ ਉਸੇ ਤਰ੍ਹਾਂ ਹੀ ਬਣਾਉਣੇ ਮੇਰੇ ਕੋਲੋਂ ਸਿੱਖੇ ਅਤੇ ਹਰ ਵਾਰੀ ਮੈਨੂੰ ਕਹਿੰਦੇ ਕਿ ਮੈਂ ਬਹੁਤ ਅੱਛੇ ਹੁਣ ਚਾਵਲ ਬਣਾਉਣੇ ਸ਼ੁਰੂ ਕਰ ਦਿੱਤੇ ਕਿ ਸਭ ਨੂੰ ਪਸੰਦ ਆਉਂਦੇ ਹੈ ਨਾਲ ਨਾਲ ਪਸੰਦ ਅਤੇ ਮੈਂ ਹੁਣ ਮੈਨੂੰ ਆਪਣੇ ਆਪ ਵਿੱਚ ਵੀ ਫੀਲ ਹੁੰਦਾ ਕਿ ਮੈਂ ਬਹੁਤ ਅੱਛਾ ਸਿਖਾ ਸਕਦੀ ਐਂ ਮੈਂ ਹੋਰਾਂ ਨੂੰ ਵੀ ਆਪਣਾ ਮੈਥਡ ਦੱਸਿਆ ਕਿ ਮੈਂ ਇਸ ਤਰ੍ਹਾਂ ਬਣਾ ਸਕਦੀ ਐਂ ਅਤੇ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਦਾ ਜਿੱਦਾਂ ਮੈਂ ਦੱਸਿਆ ਸੀ ਉੱਦਾਂ ਹੀ ਬਣਾਉਣਾ ਸਿੱਖਿਆ ਅਤੇ ਬਹੁਤ ਅੱਛੇ ਤਰੀਕੇ ਦੇ ਨਾਲ ਬਣਾਉਣਾ ਉਹਨਾਂ ਨੇ ਜਸਟ ਮੈਨੂੰ ਦੱਸਿਆ ਕਿ ਇੱਦਾਂ ਕਰੀਦਾ ਅਤੇ ਇੱਦਾਂ ਨਹੀਂ ਕਰੀਦਾ ਸਾਨੂੰ ਆਪਣੇ ਆਪ ਨੂੰ ਵੀ ਹੋਰ ਹੁੰਦਾ ਕਿ ਅਸੀਂ ਬਹੁਤ ਅੱਛਾ ਸਿਖਾਇਆ ਇਹਨਾਂ ਨੂੰ ਉਹਨਾਂ ਨੇ ਬਹੁਤ ਅੱਛਾ ਬਣਾਇਆ ਅਤੇ ਮੈਂ ਫਿਰ ਉਹਨਾਂ ਨੂੰ ਉੱਦਾਂ ਹੀ ਸਿਖਾਇਆ ਜਿੱਦਾਂ ਉਹ ਮਤਲਬ ਕਿ ਸਮਝਦੇ ਸੀ ਮੈਂ ਉਹਨਾਂ ਨੂੰ ਤੜਕਾ ਲਗਾਉਣਾ ਦੱਸਿਆ ਕਿ ਪਹਿਲੇ ਕਿਹੜੀ ਚੀਜ਼ ਪਾਉਣੀ ਚਾਹੀਦੀ ਅਤੇ ਕਿਹੜੀ ਚੀਜ਼ ਨਹੀਂ ਪਾਉਣੀ ਚਾਹੀਦੀ ਅਤੇ ਉਹ ਚੀਜ਼ ਜਿਸ ਹਿਸਾਬ ਨਾਲ ਅਸੀਂ ਪਹਿਲੇ ਚੀਜ਼ ਪਾਈ ਦੀ ਹੈ ਜਾਂ ਬਾਅਦ ਚੋਂ ਪਾਈ ਦੀ ਉਹਦਾ ਵੀ ਇੱਕ ਤਰੀਕਾ ਹੁੰਦਾ ਜਿਹਦੇ ਨਾਲ ਕਿ ਉਹ ਵਧੀਆ ਬਣਦੀ ਹੈ ਉਹ ਹੀ ਮੈਥਡ ਸਾਨੂੰ ਅੱਗੇ ਜਾ ਕੇ ਵੀ ਵਧੀਆ ਲੱਗਦਾ ਕਿ ਅਸੀਂ ਸਾਨੂੰ ਸਿਖਾਉਣ ਦਾ ਤਜਰਬਾ ਆਇਆ ਕਿ ਸਾਡੇ ਵੱਲੋਂ ਵੀ ਕਿਸੇ ਦੁਆਰਾ ਸਿੱਖਿਆ ਗਿਆ ਉਹ ਮੈਥਡ ਅਸੀਂ ਜੇ ਨਹੀਂ ਕਰ ਸਕਦੇ ਫਿਰ ਉਹ ਚੀਜ਼ ਨਹੀਂ ਬਣਦੀ ਜਦੋਂ ਸਾਡੇ ਕਿਸੇ ਦੀ ਤਾਰੀਫ਼ ਕੀਤੀ ਹੈ ਕੀ ਬਹੁਤ ਅੱਛੇ ਬਣਾ ਰਹੇ ਹੋ ਤੁਸੀਂ ਅਗਲੇ ਨੂੰ ਵੀ ਹੋਏਗਾ ਕਿ ਮੈਂ ਵੀ ਇਹ ਚੀਜ਼ ਬਣਾਉਣੀ ਸਿੱਖਾਂ ਸੋ ਆਪਣੇ ਆਪ ਵਿੱਚ ਵੀ ਸਾਨੂੰ ਇਹ ਹੁੰਦਾ ਕਿ ਅਸੀਂ ਬਣਾਉਣੀ ਸਿੱਖ ਸਕਦੇ ਹੈ ਉਹਦੇ ਕੋਲੋਂ ਸਿੱਖੋ ਬਣਾਉਣੀ ਕਿੱਦਾਂ ਬਣਾ ਬਣਾ ਸਕਦੇ ਹੋ ਅਤੇ ਕਿੱਦਾਂ ਨਹੀਂ ਬਣਾ ਸਕਦੇ ਇਹ ਵੀ ਆਪਣੀ ਇੱਕ ਓਵਰ ਸਮਾਰਟਨੈਸ ਹੁੰਦੀ ਹੈ ਕਿ ਅਸੀਂ ਬਣਾਉਣਾ ਸਿੱਖਿਆ